ਆਮ ਤੌਰ 'ਤੇ ਹੋ ਪ੍ਰਾਈਵੇਟ ਹੋਸਪਿਟਲਾਂ ਵਿੱਚ ਸਟਾਫ ਅਤੇ ਡੋਕਟਰ ਪੂਰਾ ਹੁੰਦਾ ਹੈ ਅਤੇ ਮਰੀਜ਼ ਦੀ ਦੇਖਭਾਲ ਵੀ ਆਪਣੇ ਮੈਂਬਰ ਦੀ ਤਰ੍ਹਾਂ ਕਰਦੇ ਹਨ ਅਤੇ ਸਾਫ਼ ਸਫ਼ਾਈਆਂ ਵੀ ਚੰਗੀ ਤਰ੍ਹਾਂ ਹੋਸਪਿਟਲ ਦਾ ਰੱਖਦੇ ਹਨ ਅਤੇ ਮਰੀਜ਼ ਨਾਲ ਰਲ਼ ਮਿਲ਼ ਕੇ ਰਹਿੰਦੇ ਹਨ ਇਸ ਕਰਕੇ ਡਾਕਟਰ ਅਤੇ ਸਟਾਫ ਬਹੁਤ ਹੀ ਠੀਕ ਹੁੰਦੇ ਹਨ